ਪੰਜਾਬ ਵਿੱਚ ਬਹੁਤ ਸਾਰੀਆਂ ਮਹੱਤਵਪੂਰਨ ਜਗ੍ਹਾ ਹਨ ਨਿਸ਼ਾਨ ਹਨ ਜੋ ਉਸ ਰਾਜ ਦਾ ਇਤਿਹਾਸ ਹਨ ਜਿਵੇਂ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਜਿਹਨੂੰ ਸੁਨਹਿਰੀ ਮੰਦਿਰ ਵੀ ਕਿਹਾ ਜਾਂਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਨਾਲ ਸੰਬੋਧਕ ਕੀਤਾ ਜਾਂਦਾ ਹੈ ਉਹ ਬਹੁਤ ਹੀ ਧਾਰਮਿਕ ਸਥਾਨ ਹੈ ਸਿੱਖ ਧਰਮ ਨਾਲ ਰਿਲੇਟਡ ਉੱਥੇ ਬਹੁਤ ਸ਼ਰਧਾਲੂ ਆਉਂਦੇ ਹਨ ਬਾਹਰੋਂ ਵੀ ਕਈ ਫੋਰਨ ਤੋਂ ਵੀ ਸ਼ਰਧਾਲੂ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੋ ਬਹੁਤ ਹੀ ਪਵਿੱਤਰ ਜਗ੍ਹਾ ਹੈ ਉਹਦੀ ਮੇਨ ਖਾਸੀਅਤ ਇਹ ਹੀ ਹੈ ਕਿ ਉਹ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਬਣਿਆ ਹੋਇਆ ਹੈ ਇੱਕ ਗੋਬਿੰਦਗੜ ਕਿਲ੍ਹਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲਿਆਂ ਦਾ ਬਣਿਆ ਹੋਇਆ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣੀਆਂ ਹੈ ਦੇਖਣ ਵਾਲੀਆਂ ਨੇ ਜੋ ਰਾਜ ਦੇ ਇਤਿਹਾਸ ਨੂੰ ਜਿਹੜੀਆਂ ਨੇ ਉਹ ਮੁੜ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ ਅਕਾਲ ਤਖ਼ਤ ਸਾਹਿਬ ਜਿਵੇਂ ਅੰਮ੍ਰਿਤਸਰ ਦੇ ਵਿੱਚ ਇਹ ਵੀ ਸਿੱਖ ਧਰਮ ਨਾਲ ਰਿਲੇਟਡ ਹੈ ਪੰਜਾਬ ਰਾਜ ਨਾਲ ਰਿਲੇਟਡ ਹੈ ਬਹੁਤ ਸਾਰੇ ਸਿੱਖ ਧਰਮ ਸੀ ਸਿੱਖ ਸ਼ਰਧਾਲੂ ਇਹਨਾਂ ਦੇ ਮਤਲਬ ਕਿ ਲੱਖਾਂ ਦੀ ਗਿਣਤੀ ਵਿੱਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਸੋ ਹੋਰ ਵੀ ਕਈ ਤਰ੍ਹਾਂ ਦੇ ਕਿਲ੍ਹੇ ਮੰਦਿਰ ਮਹਿਲ ਅਜਾਇਬ ਘਰ ਜਿਹੜਾ ਅੰਮ੍ਰਿਤਸਰ ਦਾ ਉਹ ਵੀ ਬਹੁਤ ਮਸ਼ਹੂਰ ਆ ਉਹਦੇ ਵਿੱਚ ਬਹੁਤ ਪੁਰਾਤਨ ਸਮੇਂ ਦੀਆਂ ਜਿਵੇਂ ਰਾਜੇ ਮਹਾਰਾਜੇ ਇੱਥੇ ਹੋਏ ਨੇ ਉਹਨਾਂ ਦੇ ਹਥਿਆਰ ਨੇ ਉਹਨਾਂ ਦੀਆਂ ਯੂਨੀਫੋਮ ਨੇ ਜਾਂ ਕਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਉਸ ਸਮੇਂ ਦੇ ਉਸ ਸਮੇਂ ਦੀਆਂ ਤੋਪਾਂ ਤਲਵਾਰਾਂ ਆਦਿ ਬਹੁਤ ਸਾਰਾ ਸਮਾਨ ਜਿਹੜਾ ਆ ਉੱਥੇ ਲੋਕਾਂ ਨੂੰ ਮਿਲਣ ਨੂੰ ਦੇਖਣ ਨੂੰ ਮਿਲਦਾ ਹੈ ਅਤੇ ਇਹਦੇ ਨਾਲ ਸਾਡਾ ਜਿਹੜਾ ਪੰਜਾਬ ਰਾਜ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਲੋਕ ਕਰਦੇ ਸੀ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ